ਖੇਤੀਬਾੜੀ ਦੀਆਂ ਨਵੀਆਂ ਨਵੀਆਂ ਤਕਨੀਕਾਂ ਆ ਗਈਆਂ ਜਿਹਦੇ ਨਾਲ ਆਪਾਂ ਨੂੰ ਬਹੁਤ ਵਧੀਆ ਦਾਣੇ ਨਿਕਲ ਰਹੇ ਹਨ ਅਤੇ ਆਮਦਨ ਦਾ ਵਧੀਆ ਜ਼ਰੀਆ ਹੋ ਗਿਆ ਹੈ ਖੇਤੀ ਦੇ ਨਵੇਂ ਨਵੇਂ ਸੰਦ ਜੋ ਕਿ ਨਵੀਂ ਤਕਨੀਕਾਂ ਆ ਗਈਆਂ ਇਹਦੇ ਨਾਲ ਹੁਣ ਪਰਾਲੀ ਸਾੜਨੀ ਨਹੀਂ ਪੈਂਦੀ ਹੈ ਉਹ ਸਾਰੇ ਹੀ ਨਵੇਂ ਜਿਹੜੇ ਟਰੈਕਟਰ ਆ ਉਹਦੇ ਨਾਲ ਪ ਪਰਾਲੀ ਵੀ ਇਕੱਠੀ ਕਰਕੇ ਵੇਚੀ ਜਾਂਦੀ ਹੈ